ਬਦਲਦੇ ਮੌਸਮ ਨਾਲ ਸਾਡੇ ਖੇਤਰ ਦੀ ਖੇਤੀ ਬਹੁਤ ਅਸਰ ਪੈ ਰਿਹਾ ਜਿੱਦਾਂ ਕਿ ਪਹਿਲਾਂ ਤਾਂ ਕਈ ਵਾਰ ਹੜ੍ਹ ਆ ਜਾਂਦੇ ਨੇ ਹੜ੍ਹ ਆਉਣ ਨਾਲ ਜਦੋਂ ਜਿਹੜੀ ਉਹ ਫਸਲ ਬੀਜੀ ਹੁੰਦੀ ਹੈ ਉਹ ਸਾਰੀ ਵਹਾ ਕੇ ਲੈ ਜਾਂਦਾ ਹੜ੍ਹ ਤਾਂ ਫਿਰ ਉਹ ਕਿੰਨਾ ਜ਼ਿਆਦਾ ਮੁਸ਼ਕਲ ਹੈ ਕਿੰਨਾ ਜ਼ਿਆਦਾ ਚੁਣੌਤੀ ਪੂਰਨ ਹੈ ਕਿਸਾਨਾਂ ਲਈ ਅਤੇ ਉਸ ਤੋਂ ਬਾਅਦ ਕਈ ਵਾਰ ਸਾਲ ਸਾਲ ਭਰ ਸੋਕਾ ਹੀ ਪਿਆ ਰਹਿੰਦਾ ਕੋਈ ਮੀਂਹ ਨਹੀਂ ਪੈਂਦਾ ਜਾਂ ਫਿਰ ਉਹਨਾਂ ਨੂੰ ਪਾਣੀ ਦੇਣ ਲਈ ਉੱਥੋਂ ਪਾਣੀ ਨਹੀਂ ਮਿਲਦਾ ਤਾਂ ਉਹ ਫਿਰ ਸੋਕਾ ਪੈ ਜਾਂਦਾ ਤਾਂ ਉਹ ਵੀ ਉਹਦਾ ਨੁਕਸਾਨ ਹੁੰਦਾ ਤਾਂ ਜਿਹੜੀ ਸਾਰੀ ਫਸਲ ਹੈ ਉਹ ਸਾਰੀ ਫਸਲ ਜਲ ਜਾਂਦੀ ਹੈ ਸੋਕੇ ਕਾਰਨ ਕਈ ਵਾਰ ਚੱਕਰਵਾਤੀ ਤੂਫਾਨ ਆ ਜਾਂਦੇ ਨੇ ਉਹ ਸਾਰੀ ਫਸਲ ਨੂੰ ਖਰਾਬ ਕਰ ਦਿੰਦੇ ਨੇ ਉਹ ਢਾਹ ਦਿੰਦੇ ਨੇ ਫਸਲ ਨੂੰ ਤਾਂ ਉਹਦੀ ਫਸਲ ਜਿਹੜੀ ਉਹ ਪੱਕੀ ਪਕਾਈ ਫਸਲ ਹੈ ਉਹ ਸਾਰੀ ਢਹਿ ਜਾਂਦੀ ਹੈ ਉਹਦਾ ਜਿਹੜਾ ਝਾੜ ਹੈ ਉਹ ਘੱਟ ਜਾਂਦਾ ਜਿਹੜਾ ਉਹਨੂੰ ਇਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਗ ਗੜੇ ਪੈਣ ਨਾਲ ਗੜੇ ਪੈਣ ਨਾਲ ਜਿਹੜੀ ਸਭ ਤੋਂ ਜ਼ਿਆਦਾ ਫਸਲ ਦਾ ਨੁਕਸਾਨ ਹੁੰਦਾ ਹੈ ਗੜੇ ਜਦੋਂ ਪੈਂਦੇ ਨੇ ਤਾਂ ਉਹ ਜਿਹੜੀ ਫਸਲ ਹੈ ਉਹਦਾ ਝਾੜ ਘੱਟ ਜਾਂਦਾ ਉਹ ਕਾਲੀ ਹੋ ਜਾਂਦੀ ਹੈ ਉਹ ਢਹਿ ਜਾਂਦੀ ਹੈ ਉਹਦਾ ਪੂਰੀ ਤਰ੍ਹਾਂ ਨੁਕਸਾਨ ਹੋ ਜਾਂਦਾ ਹੈ ਜਿਹੜੇ ਕਿਸਾਨ ਹੈ ਉਹ ਇਸ ਰਸ ਰੁਕਾਵਟ ਅਤੇ ਨੁਕਸਾਨ ਨਾਲ ਨਜਿੱਠਦੇ ਤਾਂ ਹੈ ਕਿਤੇ ਨਾ ਕਿਤੇ ਉਹਦੀ ਕ ਉਹਦੀ ਦੇਖਭਾਲ ਕਰਦੇ ਨੇ ਉਹਨੂੰ ਉਸ ਢੰਗ ਨਾਲ ਬੀਜਦੇ ਨੇ ਦੇਖਦੇ ਨੇ ਕਿ ਪਰ ਇਹ ਤਾਂ ਸਾਰਾ ਜੋ ਮੋਸ ਬਲ ਮੌਸਮ ਹੈ ਇਹ ਤਾਂ ਕੁਦਰਤੀ ਹੈ ਇਹ ਤਾਂ ਕਿਸੇ ਵੀ ਟਾਈਮ ਬਦਲ ਸਕਦਾ ਹੈ ਇਸ ਕਰਕੇ ਜਿਹੜਾ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਰਕਾਰ ਨੂੰ ਇਹ ਇਹ ਹੈ ਕਿ ਉਹਨਾਂ ਦੀ ਕਿਸਾਨਾਂ ਦੀ ਵਿੱਤੀ ਸਹਾਇਤਾ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਇੱਦਾਂ ਬਦਲਦੇ ਮੌਸਮ ਦਾ ਖੇਤੀ 'ਤੇ ਅਸਰ ਹੁੰਦਾ ਹੈ